ਮੈਮ ਤੁਸੀਂ ਆਰਤੀ ਸ਼ਰਮਾ ਬੋਲਦੇ ਮੈਮ ਕਿਵੇਂ ਹੋ ਮੈਮ ਮੈਂ ਨਾ ਤੁਹਾਡਾ ਕਮਲ ਤੋਂ ਨੰਬਰ ਲਿੱਤਾ ਸੀਗਾ ਮੈਂ ਉਰੇ ਸ਼ਿਫਟਿੰਗ ਕਰੀ ਹੈ ਕਪੂਰਥਲਾ ਦੇ ਫੇਮਸ ਰੈਸਟੋਰੈਂਟਾਂ ਬਾਰੇ ਪੁੱਛਣਾ ਸੀਗਾ ਮੈਂ ਨਵੀਂ ਨਵੀਂ ਆਈ ਹੈ ਨਾ ਤਾਂ ਉਰੇ ਤੁਹਾਨੂੰ ਪੁੱਛਣਾ ਸੀਗਾ ਕਿਵੇਂ ਦੇ ਆ ਫੇਮਸ ਕਿਹੜੇ ਕਿਹੜੇ ਹੈ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਮੈਮ ਹੋਰ ਕਿਹੜੇ ਕਿਹੜੇ ਹੈ ਉਰੇ ਹਾਂਜੀ ਹਾਂਜੀ

ਹਾਂਜੀ ਮੈਮ ਹੋਰ ਹੋਰ ਮੈਮ ਹੋਰ ਮੈਮ ਉਰੇ ਸਫਾਈ ਸਫੁਈ ਕਿੱਦਾਂ ਦੀ ਜੀ ਖਾਣਾ ਕਿਵੇਂ ਦਾ ਹੁੰਦਾ ਵਧੀਆ ਹੁੰਦਾ ਜਾਂ ਠੀਕ ਠੀਕ ਹੀ ਹੁੰਦਾ ਹਾਂਜੀ ਹਾਂਜੀ ਓਕੇ ਹੋਰ ਹਾਂਜੀ ਹਾਂਜੀ ਅੱਛਾ ਮਤਲਬ ਟਿਫਨ ਪੈਕ ਕਰਵਾ ਕੇ ਵੀ ਦੇ ਦਿੰਦੇ ਆ ਮੀਨਜ਼ ਕਿ ਡੇਲੀ ਦਾ ਟਿਫਨ ਹਾਂਜੀ ਓਕੇ ਹੋਰ ਮੈਮ ਹਾਂ ਚਲੋ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਹੋਰ ਪੁੱਛ ਲੂੰਗੀ ਥੈਂਕ ਯੂ ਹਾਂਜੀ ਠੀਕ ਹੈ